ਸਾਡੇ ਭਾਈਚਾਰੇ ਜਾਂ ਸੱਭਿਆਚਾਰ ਵਿੱਚ ਖੇਡਾਂ ਦੀ ਬਹੁਤ ਵੱਡੀ ਭੂਮਿਕਾ ਹੈ ਕੋਈ ਵੀ ਮੇਲਾ ਬਿਨਾਂ ਖੇਡਾਂ ਤੋਂ ਅਧੂਰਾ ਹੈ ਸਾਡੇ ਖੇਤਰ ਵਿੱਚ ਜਦੋਂ ਵੀ ਕੋਈ ਵੀ ਮੇਲਾ ਹੁੰਦਾ ਹੈ ਤਾਂ ਉਸ ਵਿੱਚ ਇੱਕ ਜਾਂ ਦੋ ਖੇਡਾਂ ਜ਼ਰੂਰੀ ਹੁੰਦੀਆਂ ਹਨ ਸਾਡੇ ਖੇਤਰ ਵਿੱਚ ਜ਼ਿਆਦਾਤਰ ਕੁਸ਼ਤੀ ਜਾਂ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਕਈ ਖੇਤਰਾਂ ਵਿੱਚ ਦਸਤਾਰ ਮੁਕਾਬਲਾ ਅਤੇ ਗੱਤਕਾ ਮੁਕਾਬਲਾ ਕਰਵਾਇਆ ਜਾਂਦਾ ਹੈ ਇਸ ਨਾਲ ਸਾਨੂੰ ਸਾਡੇ ਸੱਭਿਆਚਾਰ ਅਤੇ ਸਾਡੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਅਤੇ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਹਨ ਖੇਡਾਂ ਦਾ ਸਾਡੇ ਭਾਈਚਾਰੇ ਅਤੇ ਸੱਭਿਆਚਾਰ ਵਿੱਚ ਬਹੁਤ ਵੱਡੀ ਭੂਮਿਕਾ ਹੈ